ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਕਿ ਵਿਆਹਾਂ ਵਰਗੇ ਵੱਡੇ ਸਮਾਰੋਹਾਂ ਦੌਰਾਨ ਪਾਣੀ ਦਾ ਪ੍ਰਬੰਧ ਕਰਨ ਲਈ ਮਿਊਂਸੀਪਲ ਕਮੇਟੀ ਵੱਲੋਂ ਟੈਂਕਰ ਮੰਗਵਾਏ ਜਾਂਦੇ ਹਨ ਇਹਨਾਂ ਟੈਂਕਰਾਂ ਨਾਲ ਪਾਣੀ ਦੀ ਪੂਰਤੀ ਕੀਤੀ ਜਾਂਦੀ ਹੈ ਇਸ ਤੋਂ ਇਲਾਵਾ ਪਾਣੀ ਦੀ ਪੂਰਤੀ ਲਈ ਮੋਟਰ ਚਲਾ ਕੇ ਵੀ ਪਾਣੀ ਲਿਆ ਜਾ ਸਕਦਾ ਹੈ ਜੇਕਰ ਬਿਜਲੀ ਦੀ ਸਪਲਾਈ ਚਾਲੂ ਰਹੇ ਤਾਂ ਜਿੰਨਾ ਪਾਣੀ ਸਾਨੂੰ ਚਾਹੀਦਾ ਹੈ ਓਨਾ ਹੀ ਲੈ ਸਕਦੇ ਹਾਂ ਜਦ ਕਿ ਜੇ ਅਸੀਂ ਟੈਂਕਰ ਮੰਗਵਾਉਂਦੇ ਹਾਂ ਤਾਂ ਇਹ ਡਰ ਬਣਿਆ ਰਹਿੰਦਾ ਹੈ ਕਿ ਪਾਣੀ ਕਿਤੇ ਜਲਦੀ ਹੀ ਖ਼ਤਮ ਨਾ ਹੋ ਜਾਵੇ ਜੇਕਰ ਵਿਆਹ ਸਮਾਰੋਹ ਦੌਰਾਨ ਪਾਣੀ ਦੀ ਕੋਈ ਵੀ ਸਮੱਸਿਆ ਆਉਂਦੀ ਹੈ ਤਾਂ ਹੋਰ ਪਾਣੀ ਦਾ ਇੰਤਜ਼ਾਮ ਕਰਨ ਲਈ ਟੈਂਕਰ ਮੰਗਵਾਉਣਾ ਪੈ ਸਕਦਾ ਹੈ ਅੱਜ ਕੱਲ੍ਹ ਬੰਦ ਗਿਲਾਸ ਜਾਂ ਬੰਦ ਬੋਤਲਾਂ ਦਾ ਬੋਲਬਾਲਾ ਹੈ ਜੋ ਕਿ ਬਾਜ਼ਾਰ ਵਿੱਚ ਠੀਕ ਕੀਮਤ 'ਤੇ ਮਿਲ ਜਾਂਦੇ ਹਨ ਜਿਸ ਨਾਲ ਵਿਆਹ ਸਮਾਰੋਹ ਨੇਪਰੇ ਚੜ੍ਹ ਜਾਂਦਾ ਹੈ ਜੇਕਰ ਗਿਲਾਸ ਜਾਂ ਬੋਤਲਾਂ ਖਤਮ ਹੋ ਜਾਣ ਤਾਂ ਤੁਰੰਤ ਮੰਗਵਾਇਆ ਵੀ ਜਾ ਸਕਦਾ ਹੈ